ਪੰਜਾਬੀ ਜਾਗਰਣ ਇਹ ਜਾਗਰਣ ਗਰੁੱਪ ਦੁਆਰਾ ਛਾਪਿਆ ਜਾਂਦਾ ਹੈ ਇਸ ਵਿੱਚ ਭਾਰਤੀ ਪੰਜਾਬ ਭਾਰਤ ਦੇ ਦੁਨੀਆਂ ਦੇ ਵੱਖਰੇ ਵੱਖਰੇ ਹਿੱਸਿਆਂ ਦੀਆਂ ਖ਼ਬਰਾਂ ਸ਼ਾਮਿਲ ਹੁੰਦੀਆਂ ਸਨ ਇਹ ਅਖ਼ਬਾਰ ਪੰਜਾਬ ਵਿੱਚ ਬਹੁਤ ਹੀ ਪ੍ਰਸਿੱਧ ਹੈ ਪੰਜਾਬ ਦੇ ਬਹੁਤ ਸਾਰੇ ਘਰਾਂ ਵਿੱਚ ਹਰ ਰੋਜ਼ ਸਵੇਰ ਇਹ ਅਖ਼ਬਾਰ ਪੜ੍ਹਿਆ ਜਾਂਦਾ ਹੈ ਜਿਸ ਵਿੱਚ ਕਿ ਬਹੁਤ ਹੀ ਮਹੱਤਵਪੂਰਨ ਅਤੇ ਵਿਸ਼ਿਆ ਨਾਲ ਰੁੱਝੀਆਂ ਤਸਵੀਰਾਂ ਆਉਂਦੀਆਂ ਹਨ ਮੈਨੂੰ ਵੀ ਖੁਦ ਨੂੰ ਬਹੁਤ ਪਸੰਦ ਹੈ ਅਖ਼ਬਾਰ ਪੜ੍ਹਨਾ ਮੈਂ ਰੋਜ਼ ਸਵੇਰੇ ਉੱਠ ਕੇ ਇਹ ਅਖ਼ਬਾਰ ਪੜ੍ਹਦੀ ਹਾਂ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਅਖ਼ਬਾਰ ਹੁੰਦੇ ਹਨ ਜਿਵੇਂ ਕਿ ਅਜੀਤ ਜਗਬਾਣੀ ਅਖ਼ਬਾਰ ਆਦਿ ਜੁਟਰੋਮਨ ਇਹ ਬਹੁਤ ਹੀ ਵਧੀਆ ਹਨ ਅਜੀਤ ਅਖ਼ਬਾਰ ਜ਼ਿਆਦਾਤਰ ਹਰ ਰਸਾਲੇ ਕਹਾਣੀਆਂ ਕਵਿਤਾਵਾਂ ਲੇਖ ਅਰਜ਼ੀਆਂ ਆਦਿ ਨਾਲ ਸਬੰਧਿਤ ਹਨ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦੇ ਹਨ ਪੜ੍ਹਨ ਵਿੱਚ ਅਜੀਤ ਅਖ਼ਬਾਰ ਵਿੱਚ ਹਰ ਐਤਵਾਰ ਲੜੀਵਾਰ ਕਹਾਣੀਆਂ ਆਉਂਦੀਆਂ ਜੋ ਕਿ ਇੱਕ ਬਹੁਤ ਹੀ ਵਧੀਆ ਢੰਗ ਨਾਲ ਲਿਖੀਆਂ ਹੁੰਦੀਆਂ ਹਨ ਜੋ ਕਿ ਸਾਨੂੰ ਪੜ੍ਹਨ ਵਿੱਚ ਬਹੁਤ ਹੀ ਵਧੀਆ ਹੁੰਦੀਆਂ ਹਨ ਜੋ ਕਿ ਬਹੁਤ ਹੀ ਵਧੀਆ ਤਰ੍ਹਾਂ ਨਾਲ ਲਿਖੀਆਂ ਜਾਂਦੀਆਂ ਹਨ ਪਰ ਮੇਰਾ ਮਨਪਸੰਦ ਅਖ਼ਬਾਰ ਪੰਜਾਬੀ ਜਾਗਰਣ ਹੀ ਹੈ ਕਿਉਂਕਿ ਇਸ ਵਿੱਚ ਦੇਸ਼ ਭਰ ਦੀਆਂ ਖ਼ਬਰਾਂ ਚੁਟਕਲੇ ਆਦਿ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਹਨ ਜੋ ਕਿ ਵਧੀਆ ਸਹੀ ਢੰਗ ਤਰੀਕੇ ਨਾਲ ਲਿਖੀਆਂ ਜਾਂਦੀਆਂ ਹਨ ਜਾਗਰਣ ਅਖ਼ਬਾਰ ਬਹੁਤ ਹੀ ਮਸ਼ਹੂਰ ਅਖ਼ਬਾਰ ਹੈ ਜਿਸ ਨੂੰ ਲੋਕ ਹਰ ਘਰ ਵਿੱਚ ਪੜ੍ਹਦੇ ਹਨ ਅਤੇ ਬਹੁਤ ਹੀ ਆਪਣੇ ਮਨ ਨੂੰ ਪ੍ਰਗਵਟ ਕਰਦੇ ਹਨ ਇਹ ਸੰਸਾਰ ਦੇ ਹਰ ਹਿੱਸੇ ਵਿੱਚ ਜਾਣਕਾਰੀ ਹਾਸਿਲ ਕਰਨ ਦੇ ਸਹੂਲਤ ਪ੍ਰਦਾਨ ਕਰਦਾ ਹੈ